ਸ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਮਹੀਨੇ ਪਹਿਲਾਂ ਤੁਹਾਡੇ ਤੋਂ ਫੋਨ ਮੰਗਵਾਇਆ ਸੀ ਉਸਦੀ ਪੈਕਜਿੰਗ ਬਹੁਤ ਵਧੀਆ ਹੈ ਮੈਂ ਜਦੋਂ ਡੱਬਾ ਖੋਲ੍ਹ ਕੇ ਵੇਖਿਆ ਤਾਂ ਉਹ ਉਹੀ ਫੋਨ ਸੀ ਜੋ ਮੈਂ ਮੰਗਵਾਇਆ ਸੀ ਮੈਂ ਰੈਡਮੀ ਨਾਈਨ ਦਾ ਫੋਨ ਮੰਗਵਾਇਆ ਸੀ ਅਤੇ ਜੋ ਤੁਹਾਡਾ ਡਿਲੀਵਰੀ ਬੋਆਏ ਫੋਨ ਦੇ ਕੇ ਗਿਆ ਹੈ ਉਸ ਦਾ ਨੇਚਰ ਬਹੁਤ ਵਧੀਆ ਸੀ ਉਹ ਬਹੁਤ ਵਧੀਆ ਗੱਲਾਂ ਕਰ ਰਿਹਾ ਸੀ ਫੋਨ ਫੋਨ ਦੀ ਡਿਸਪਲੇ ਬਹੁਤ ਵਧੀਆ ਹੈ ਅਤੇ ਉਹ ਰੁਕ ਰੁਕ ਕੇ ਵੀ ਨਹੀਂ ਚਲਦਾ ਉਹ ਉਸਦੀ ਬੈਟਰੀ ਵੀ ਬਹੁਤ ਵਧੀਆ ਹੈ ਉਹ ਦੋ ਦਿਨ ਕੱਢ ਦਿੰਦੀ ਹੈ ਅਤੇ ਉਸਦਾ ਬੈਕ ਕੈਮਰਾ ਵੀ ਬਹੁਤ ਵਧੀਆ ਹੈ ਉਹ ਫੋਟੋਆਂ ਬਹੁਤ ਵਧੀਆ ਖਿੱਚਦਾ ਹੈ ਅਤੇ ਉਹ ਬਲੈਕ ਫੋਟੋਆਂ ਨਹੀਂ ਦਿਖਾਉਂਦਾ ਅਤੇ ਉਸਦੀ ਫਰੰਟ ਕੈਮਰਾ ਵੀ ਬਹੁਤ ਵਧੀਆ ਹੈ ਅਤੇ ਉਹ ਸਾਨੂੰ ਮਾਰਕੀਟ ਨਾਲੋਂ ਬਹੁਤ ਸਸਤਾ ਮਿਲਿਆ ਹੈ ਅਤੇ ਅਸੀਂ ਤੁਹਾਨੂੰ ਤੁਹਾਡੇ ਕੋਲੋਂ ਫਿਰ ਇਵੇਂ ਦਾ ਫੋਨ ਹੀ ਮੰਗਵਾਵਾਂਗੇ ਧੰਨਵਾਦ